ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਇਲਾਕੇ ਦੇ ਲੋਕਾਂ ਨੇ ਰੁੱਖ ਲਗਾਉਣ ਦੇ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਸਾਡੇ ਪਿੰਡ ਦੇ ਲੋਕਾਂ ਨੇ ਆਪਣੇ ਪੱਧਰ 'ਤੇ ਜਿੰਨਾ ਕੁ ਹੋ ਸਕੇ ਰੁੱਖਾਂ ਦੀ ਮਹੱਤਤਾ ਨੂੰ ਦੱਸਦੇ ਹੋਏ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਓਥੇ ਹੀ ਆਪਣੇ ਆਪਣੇ ਤਰੀਕੇ ਦੇ ਨਾਲ ਟੈਮ ਟੂ ਟੈਮ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਛੋਟੇ ਜਿਹੇ ਨਾਟਕ ਦੇ ਰਾਹੀਂ ਲੋਕਾਂ ਨੂੰ ਪ੍ਰੇਰਿਆ ਅਤੇ ਉਨ੍ਹਾਂ ਨੂੰ ਐਂਡ 'ਤੇ ਨਾਟਕ ਦੇ ਵਿੱਚ ਇੱਕ ਪ੍ਰੇਰਨਾ ਦੇ ਤੌਰ 'ਤੇ ਉਨ੍ਹਾਂ ਨੂੰ ਇੱਕ ਗੱਲ ਸਮਝਾਈ ਗਈ ਕਿ ਰੁੱਖਾਂ ਦੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀ ਮਹੱਤਤਾ ਹੈ ਅਤੇ ਸਾਡੇ ਜੀਵਨ ਦੇ ਵਿੱਚ ਰੋਲ ਜਾਣੀ ਕਿ ਬਹੁਤ ਜ਼ਿਆਦਾ ਅਹਿਮ ਰੋਲ ਸਾਡੇ ਜੀਵਨ ਦੇ ਵਿੱਚ ਇਹ ਅਦਾ ਕਰਦੇ ਨੇ ਰੁੱਖ ਜਿਵੇਂ ਕਿ ਸ਼ੁਰੂ ਤੋਂ ਹੀ ਇੱਕ ਆਪਾਂ ਕਹਿ ਦਈਏ ਇੱਕ ਲੈਨ ਜੁੜੀ ਹੋਈ ਹੈ ਕਿ ਇੱਕ ਰੁੱਖ ਸੌ ਸੁੱਖ ਇੱਦਾਂ ਉਹਨਾਂ ਨੂੰ ਕਈ ਪ੍ਰਕਾਰ ਦੇ ਜਿਹੜੇ ਹੈਗੇ ਨੇ ਉਨ੍ਹਾਂ ਨੂੰ ਆਪਾਂ ਕਹਿ ਦਈਏ ਵੀ ਨਾਅਰੇ ਉਨ੍ਹਾਂ ਨੂੰ ਅਸੀਂ ਦੱਸੇ ਇਨ੍ਹਾਂ ਦੇ ਇੱਦਾਂ ਦੇ ਇਨ੍ਹਾਂ ਨੂੰ ਅਸੀਂ ਸਲੋਗਨ ਦੱਸੇ ਵੀ ਇਨ੍ਹਾਂ ਦੀ ਇਮਪੋਟੈਂਸ ਦੱਸੀ ਦਰਖਤਾਂ ਦੀ ਅਤੇ ਉਨ੍ਹਾਂ ਨੂੰ ਦੱਸਿਆ ਵੀ ਸਾਡਾ ਆਲਾ ਦੁਆਲਾ ਸਾਡਾ ਵਾਤਾਵਰਨ ਜਿਹੜਾ ਉਹ ਹੈ ਉਹ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਇਸਦੇ ਲਈ ਸਾਨੂੰ ਇਸ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਸਾਨੂੰ ਵੱਧ ਤੋਂ ਵੱਧ ਜਿਹੜੇ ਰੁੱਖ ਆ ਉਹਨਾਂ ਨੂੰ ਲਗਾਉਣੇ ਚਾਹੀਦੇ ਨੇ ਨਾਲ ਹੀ ਅਸੀਂ ਪਿੰਡ ਵਿੱਚ ਜੋ ਸਾਡੇ ਪਿੰਡ ਵਿੱਚ ਇੱਕ ਕਲੱਬ ਬਣਿਆ ਹੈਗਾ ਸ਼ਹੀਦ ਊਧਮ ਸਿੰਘ ਵੈਲਫ਼ੇਅਰ ਕਲੱਬ ਉਹਦੇ ਰਾਹੀਂ ਅਸੀਂ ਜੁੜ ਕੇ ਪਿੰਡ ਦੇ ਲੋਕਾਂ ਨੂੰ ਅਸੀਂ ਵੱਧ ਤੋਂ ਵੱਧ ਬੂਟੇ ਲਗਾਉਣ ਪ੍ਰਤੀ ਪ੍ਰੇਰਿਆ ਅਤੇ ਨਾਲ ਹੀ ਅਸੀਂ ਪਿੰਡ ਵਿੱਚ ਕੁਝ ਫ੍ਰੀ ਬੂਟੇ ਵੰਡੇ ਅਤੇ ਨਾਲ ਅਸੀਂ ਜਾ ਕੇ ਪਿੰਡ ਵਿੱਚ ਕਈ ਥਾਵਾਂ 'ਤੇ ਅਲੱਗ ਅਲੱਗ ਥਾਵਾਂ 'ਤੇ ਬੂਟੇ ਲਗਵਾਏ ਇਸ ਪ੍ਰਕਾਰ ਅਸੀਂ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਸ ਨਾਲ ਹੀ ਅਸੀਂ ਉਨ੍ਹਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਦੂਸਰੇ ਪਾਸੇ ਅਸੀਂ ਗੱਲ ਕਰਦੇ ਹਾਂ ਕਿ ਰੁੱਖਾਂ ਦੀ ਕਟਾਈ ਸਾਨੂੰ ਨਹੀਂ ਕਰਨੀ ਚਾਹੀਦੀ ਬਲਕਿ ਸਾਨੂੰ ਵੱਧ ਤੋਂ ਵੱਧ ਰੁੱਖਾਂ ਨੂੰ ਲਗਾਉਣੇ ਚਾਹੀਦੇ ਨੇ ਕਿਉਂਕਿ ਸਾਡਾ ਵਾਤਾਵਰਨ ਇਸ ਨਾਲ ਹਰਿਆ ਭਰਿਆ ਰਹਿੰਦਾ ਅਤੇ ਸਾਡਾ ਜੀਵਨ ਵੀ ਇਹਦੇ ਨਾਲ ਬਹੁਤ ਖੁਸ਼ਹਾਲ ਰਹਿੰਦਾ ਹੈ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਇੱਕ ਰੁੱਖ ਜ਼ਰੂਰ ਲਗਾਈਏ ਇਸ ਨਾਲ ਸਾਨੂੰ ਬਹੁਤ ਜ਼ਿਆਦਾ ਹੀ ਸਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਪੈਦਾ ਹੋਵੇਗੀ ਅਤੇ ਨਾਲ ਹੀ ਕੀ ਹੈ ਸਾਡੀ ਜਿਉਣ ਦੀ ਜਿਹੜੀ ਹੈਗੀ ਐ ਉਹ ਹੋਰ ਜਿਹੜੀ ਹੈਗੀ ਆ ਉਹ ਸਾਡੀ ਉਮਰ ਵੱਧ ਜਾਵੇਗੀ ਕਿਉਂਕਿ ਰੁੱਖ ਅਗਰ ਸਾਨੂੰ ਚੰਗੀ ਸ਼ੁੱਧ ਹਵਾ ਮਿਲਦੀ ਰਹੇਗੀ ਤਾਂ ਸਾਡਾ ਜੀਵਨ ਉਹ ਵੀ ਸਾਡੀ ਸਿਹਤ ਵੀ ਸਾਡੀ ਚੰਗੀ ਰਹੇਗੀ ਇਸ ਲਈ ਸਾਨੂੰ ਰੁੱਖ ਨਹੀਂ ਕੱਟਣੇ ਚਾਹੀਦੇ ਸਗੋਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ ਅਗਰ ਅਸੀਂ ਰੁੱਖ ਕੱਟਾਂਗੇ ਤਾਂ ਇਸਦੇ ਨਾਲ ਸਾਡੀ ਜਿਹੜੀ ਹੈਗੀ ਐ ਵਾਤਾਵਰਨ ਵੀ ਪ੍ਰਦੂਸ਼ਿਤ ਹੋਏਗਾ ਅਤੇ ਦੂਜੇ ਪਾਸੇ ਇਸ ਦੇ ਨਾਲ ਸਾਡੇ ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਵੀ ਜਿਹੜੀਆਂ ਹੈਗੀਆਂ ਸਨ ਉਹ ਫੈਲ ਸਕਦੀਆਂ ਨੇ ਕਿਉਂਕਿ ਰੁੱਖਾਂ ਦੀ ਬਹੁਤ ਜ਼ਿਆਦਾ ਇਹ ਮਹੱਤਤਾ ਹੈ ਇਨ੍ਹਾਂ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਜੜ੍ਹੀ ਬੂਟੀਆਂ ਫ਼ਲ ਸਾਨੂੰ ਜੋ ਕਿ ਸਾਨੂੰ ਮਿਲਦੇ ਨੇ